ਪੰਦਰ੍ਹਾਂ ਨਵੰਬਰ ਉੱਨੀ ਸੌ ਅੱਸੀ ਤੀਹ ਜਨਵਰੀ ਦੋ ਹਜ਼ਾਰ ਵੀਹ ਨੌ ਮਾਰਚ ਦੋ ਹਜ਼ਾਰ ਦਸ ਪੱਚੀ ਜੁਲਾਈ ਦੋ ਹਜ਼ਾਰ ਵੀਹ ਅਗਸਤ ਦੋ ਹਜ਼ਾਰ ਬਾਰ੍ਹਾਂ